ਹੈਲੋ ਬਾਈ ਜੀ ਤੁਸੀਂ ਕਿਸੇ ਟਰੈਵਲ ਏਜੰਸੀ ਤੋਂ ਬੋਲ ਰਹੇ ਆ ਅਤੇ ਅਸਲੀ ਅਸੀਂ ਨਾ ਪੰਦਰ੍ਹਾਂ ਕੁ ਦਿਨ ਪਹਿਲਾਂ ਇੱਕ ਕੈਬ ਬੁੱਕ ਕਰਵਾਈ ਸੀ ਤੁਹਾਡੇ ਬਲੈਕ ਕਲਰ ਦੀ ਅਤੇ ਉਹ ਕੈਬ ਸਵੇਰੇ ਸਾਢੇ ਸੱਤ ਵਜੇ ਅਸੀਂ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਬੁੱਕ ਕਰਵਾਈ ਸੀ ਕੈਬ ਦਾ ਤਜ਼ਰਬਾ ਵੀ ਸਾਡਾ ਬਹੁਤ ਵਧੀਆ ਰਿਹਾ ਬੈਠਣ ਦੇ ਵਿੱਚ ਵੀ ਕੰਫਰਟੇਬਲ ਸੀ ਗੱਡੀ ਅਤੇ ਗੱਡੀ ਦਾ ਜਿਹੜਾ ਡਰਾਈਵਰ ਸੀ ਉਹਦਾ ਜਿਹੜਾ ਐਕਸਪੀਰੀਅੰਸ ਵੀ ਸਾਡੇ ਨਾਲ ਬਹੁਤ ਵਧੀਆ ਰਿਹਾ ਅਤੇ ਸੁਭਾਅ ਵੀ ਉਹਨਾਂ ਦਾ ਬਹੁਤ ਚੰਗਾ ਸੀ ਬਾਕੀ ਜਿੱਥੇ ਰੁਕਣ ਨੂੰ ਕਹਿੰਦੇ ਸੀ ਰੁਕ ਜਾਂਦੇ ਸੀ ਅਤੇ ਜਦੋਂ ਚੱਲਣ ਨੂੰ ਕਹਿੰਦੇ ਚੱਲ ਚੱਲ ਪੈਂਦੇ ਸੀ ਕਿਸੇ ਢਾਬੇ 'ਤੇ ਰੁਕਣਾ ਸੀ ਢਾਬੇ 'ਤੇ ਰੁਕ ਲੈਂਦੇ ਸੀ ਕਿਸੇ ਰੈਸਟੋਰੈਂਟ 'ਤੇ ਰੁਕਣਾ ਸੀ ਤਾਂ ਰੈਸਟੋਰੈਂਟ 'ਤੇ ਰੁਕ ਜਾਂਦੇ ਸੀ ਅਤੇ ਖਿੜੇ ਮੱਥੇ ਡਰਾਈਵਰ ਰੋਕਦਾ ਸੀ ਅਤੇ ਖਿੜੇ ਮੱਥੇ ਹੀ ਤੁਰਦਾ ਸੀ ਹੈ ਨਾ ਅਤੇ ਉਹ ਡਰਾਈਵਰ ਨਾਲ ਵੀ ਸਾਡਾ ਜਿਹੜਾ ਤਜ਼ਰਬਾ ਬਹੁਤ ਵਧੀਆ ਰਿਹਾ ਤੁਹਾਡੀ ਏਜੰਸੀ ਦੇ ਨਾਲ ਵੀ ਅਤੇ ਉਹ ਕੈਬ ਦੇ ਨਾਲ ਵੀ ਅਤੇ ਅਸੀਂ ਨਾ ਇਸ ਵਾਰ ਸਾਡਾ ਸਫਰ ਹੈ ਰਾਤ ਦਾ ਪਹਿਲਾਂ ਜਿਹੜਾ ਸਾਡਾ ਸਫਰ ਸੀ ਉਹ ਦਿਨ ਦਾ ਸੀ ਅਤੇ ਇਹ ਸਫਰ ਰਾਤ ਨੂੰ ਸਾਢੇ ਨੌ ਤੋਂ ਤਕਰੀਬਨ ਮਤਲਬ ਵਕਫੇ ਦੇ ਹਿਸਾਬ ਨਾਲ ਹੋਏਗਾ ਪਰ ਇਸ ਵਾਰ ਅਸੀਂ ਅੰਮ੍ਰਿਤਸਰ ਨਹੀਂ ਪਠਾਨਕੋਟ ਜਾਣਾ ਅਤੇ ਜੇ ਤੁਸੀਂ ਕਿਰਪਾ ਕਰਕੇ ਉਹੀ ਡਰਾਈਵਰ ਉਹੀ ਕੈਬ ਸਾਨੂੰ ਦੁਬਾਰਾ ਜਿਹੜੀ ਆ ਉਹਦੀ ਸਰਵਿਸ ਦੇ ਸਕੋ ਅਤੇ ਤੁਹਾਡਾ ਬਹੁਤ ਧੰਨਵਾਦ ਹੋਏਗਾ ਅਤੇ ਇਸ ਵਾਰ ਅਸੀਂ ਐ ਜਿਹੜੀ ਉਹਦੀ ਕੀਮਤ ਵੀ ਪਹਿਲਾਂ ਨਾਲੋਂ ਆ ਜਿਹੜੀ ਉਹ ਵੱਧ ਦੇਣ ਨੂੰ ਤਿਆਰ ਹਾਂ ਪਰ ਹਾਂ ਸ਼ਰਤ ਇਹ ਹੈ ਕਿ ਡਰਾਈਵਰ ਪਹਿਲਾਂ ਵਾਲਾ ਹੀ ਜ਼ਰੂਰ ਹੋਵੇ ਹੈ ਨਾ ਅਤੇ ਕੈਬ ਜੇ ਹੋਰ ਵੀ ਹੋਈ ਕੋਈ ਗੱਡੀ ਇਹਦੇ ਵਿੱਚ ਤਾਂ ਉਹਦੀ ਹਾਲਤ ਆ ਜਿਹੜੀ ਕੰਡੀਸ਼ਨ ਆ ਉਹ ਚੰਗੀ ਹੋਵੇ ਅਤੇ ਕਿਰਪਾ ਕਰਕੇ ਅਰੇਂਜਮੈਂਟ ਸਾਡਾ ਜਲਦੀ ਕਰਵਾ ਦਿਓ ਬਹੁਤ ਧੰਨਵਾਦ